ਜਿੱਦਾਂ ਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਅੰਤਰਰਾਸ਼ਟਰੀ ਸੰਬੰਧਾਂ ਨਾਲ ਸਾਡੇ ਦੇਸ਼ ਦਾ ਵਿਕਾਸ ਹੁੰਦਾ ਹੈ ਜਿਵੇਂ ਕਿ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜੋ ਕਿ ਸਾਡੇ ਦੇਸ਼ ਵਿੱਚ ਨਹੀਂ ਹੁੰਦੀਆਂ ਅਸੀਂ ਉੱਥੋਂ ਦੂਜੇ ਦੇਸ਼ ਵਿੱਚੋਂ ਖਰੀਦਦੇ ਹਾਂ ਅਤੇ ਜਿਹੜੀਆਂ ਉਹਨਾਂ ਦੇ ਦੇਸ਼ ਬਾਹਰਲੇ ਦੇਸ਼ਾਂ ਵਿੱਚ ਜਿਹੜੀਆਂ ਚੀਜ਼ਾਂ ਨਹੀਂ ਹੁੰਦੀਆਂ ਉਹ ਸਾਡੇ ਦੇਸ਼ ਤੋਂ ਮੰਗਵਾਉਂਦੇ ਹਨ ਇਸ ਨਾਲ ਸਾਡੇ ਦੇਸ਼ ਦਾ ਵਿਕਾਸ ਤਾਂ ਹੁੰਦਾ ਹੀ ਹੈ ਨਾਲ ਦੇ ਨਾਲ ਸਾਡੇ ਆਪਸ ਵਿੱਚ ਸੰਬੰਧ ਵੀ ਹੋਰ ਵਧੀਆ ਬਣ ਜਾਂਦੇ ਹਨ ਜਿਸ ਨਾਲ ਸਾਡੇ ਬੱਚਿਆਂ ਵਿੱਚ ਵੀ ਵਿਕਾਸ ਹੁੰਦਾ ਹੈ ਬੱਚਿਆਂ ਦੀ ਵੀ ਤਰੱਕੀ ਹੁੰਦੀ ਹੈ ਸਾਡੇ ਕੰਮਾਂ 'ਚ ਤਰੱਕੀ ਹੁੰਦੀ ਹੈ ਬੱਚੇ ਹੋਰ ਵੀ ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਹਨ ਸਾਨੂੰ ਆਪਣੇ ਕੰਮਾਂ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਦੀ ਕਰਨ ਵਿੱਚ ਵੀ ਵਾਧਾ ਮਿਲਦਾ ਹੈ ਵਿੱਚ ਮਦਦ ਮਿਲਦੀ ਹੈ ਅਸੀਂ ਹੋਰ ਵਧੀਆ ਤਰੀਕੇ ਨਾਲ ਆਪਣੇ ਦੇਸ਼ ਨੂੰ ਚਲਾ ਸਕਦੇ ਹਾਂ ਅਤੇ ਆਪਣੇ ਸੰਬੰਧਾਂ ਨੂੰ ਹੋਰ ਵਧੀਆ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਘੁੰਮਣ ਦਾ ਘੁੰਮਣ ਵਿੱਚ ਵੀ ਵਾਧਾ ਹੈ ਬੱਚੇ ਵੀ ਬਾਹਰ ਜਾ ਸਕਦੇ ਹਨ ਘੁੰਮਣ ਜਾ ਸਕਦੇ ਹਨ ਅਤੇ ਅਸੀਂ ਵੀ ਹੋਰ ਵੀ ਸਾਡੇ ਦੇਸ਼ ਵਿੱਚ ਹੋਰ ਪੈਸੇ ਦਾ ਵੀ ਵਾਧਾ ਹੁੰਦਾ ਹੈ ਜਦੋਂ ਸਾਡੇ ਕੋਲੋਂ ਕੋਈ ਚੀਜ਼ਾਂ ਮੰਗਵਾਉਂਦੇ ਹਨ ਅਤੇ ਸਾਡੇ ਅਸੀਂ ਵੀ ਉਹਨਾਂ ਵੱਲੋਂ ਕੋਈ ਚੀਜ਼ਾਂ ਮੰਗਵਾਉਂਦੇ ਹਾਂ ਇਸ ਨਾਲ ਦੇਸ਼ ਦਾ ਵਿਕਾਸ ਤੇ ਹੁੰਦਾ ਹੀ ਹੈ ਸਾਡੇ ਬੱਚਿਆਂ ਵਿੱਚ ਵੀ ਤਰੱਕੀ ਬੱਚਿਆਂ ਵਿੱਚ ਵੀ ਉਹਨਾਂ ਦੇ ਕੰਮਾਂ 'ਚ ਤਰੱਕੀ ਹੁੰਦੀ ਹੈ ਪੜ੍ਹਾਈ ਦੇ ਵਿੱਚ ਤਰੱਕੀ ਹੁੰਦੀ ਹੈ ਧੰਨਵਾਦ